ਦੇਖੋ ਆਪਣੀ ਜਿਹੜੀ ਮੇਨ ਭਾਸ਼ਾ ਪੰਜਾਬੀ ਆਪਾਂ ਉਸ ਨੂੰ ਮੇ ਮਹੱਤਤਾ ਹੀ ਨਹੀਂ ਦੇ ਰਹੇ ਕਿਉਂ ਕਿਉਂਕਿ ਅੱਜ ਕੱਲ੍ਹ ਸਾਰੇ ਲੋਕ ਪੰ ਇੰਗਲਿਸ਼ 'ਚ ਜਾ ਰਹੇ ਹਨ ਠੀਕ ਹੈ ਜੀ ਬਾਹਰ ਜਾ ਰਹੇ ਆ ਉਹ ਆਪਣੇ ਬੱਚਿਆਂ ਨੂੰ ਇੰਗਲਿਸ਼ ਸਿਖਾ ਰਿਹਾ ਕਿਉਂਕਿ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਵਧੀਆ ਬਣਨ ਕੋਈ ਜ ਨੌਕਰੀ ਵਗੈਰਾ ਕੁਛ ਮਿਲੇ ਠੀਕ ਹੈ ਜੀ ਜਿਹੜੀ ਆਪਣੀ ਮੇਨ ਭਾਸ਼ਾ ਪੰਜਾਬੀ ਆਪਾਂ ਉਹ ਬੱਚੇ ਨੂੰ ਆਪਾਂ ਸਿਖਾ ਹੀ ਨਹੀਂ ਰਹੇ ਕਿਉਂਕਿ ਆਪਾਂ ਪੇਰੈਂਟਸ ਮੀਟਿੰਗ 'ਤੇ ਜਾਂਦੇ ਦੇਖੋ ਜਦੋਂ ਵੱਡੇ ਸਕੂਲਾਂ ਵਿੱਚ ਉਹ ਆਪਣੇ ਨਾਲ ਇੰਗਲਿਸ਼ 'ਚ ਗੱਲ ਕਰਦੇ ਆਪਾਂ ਨੂੰ ਸਮਝ ਨਹੀਂ ਆਉਂਦੀ ਠੀਕ ਹੈ ਜੀ ਕਿਉਂਕਿ ਆਪਾਂ ਇੰਨਾ ਪੜ੍ਹੇ ਨਹੀਂ ਅ ਅੱਜ ਕੱਲ੍ਹ ਦੇ ਪੇਰੈਂਟਸ ਠੀਕ ਹੈ ਇੰਨਾ ਪੜ੍ਹੇ ਆ ਹੁਣ ਪਿਛਲੇ ਜਮਾਨਿਆਂ ਦੇ ਪੇਰੈਂਟਸ ਇੰਨਾ ਨਹੀਂ ਪੜ੍ਹੇ ਜਦੋਂ ਪੈ ਮੀਟਿੰਗ 'ਤੇ ਜਾਂਦੇ ਪੇਰੈਂਟਸ ਮੀਟਿੰਗ 'ਤੇ ਉਹ ਆਪਣੇ ਵੀ ਟੀਚਰਸ ਨਾਲ ਗੱਲ ਕਰਦੇ ਆ ਉਹ ਇੰਗਲਿਸ਼ ਬੋਲਦੇ ਆ ਆਪਾਂ ਪੰਜਾਬੀ ਆਪਾਂ ਨੂੰ ਅਨਪੜ੍ਹ ਹੁੰਦੇ ਹਾਂ ਠੀਕ ਹੈ ਜੀ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਕਹਿ ਰਿਹਾ ਠੀਕ ਫਿਰ ਆਪਾਂ ਨੂੰ ਬੇਇੱਜ਼ਤੀ ਫੀ ਫੀਲ ਹੁੰਦੀ ਆ ਆਪਾਂ ਇੱਥੋਂ ਕਹਿੰਦੇ ਹਾਂ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਪੰਜਾਬੀ ਨੂੰ ਆਪਾਂ ਮਹੱਤਤਾ ਦੇਣੀ ਚਾਹੀਦੀ ਹੈ ਵੀ ਉਹ ਕੱਲ੍ਹ ਨੂੰ ਆਪਣੇ ਨਾਲ ਪੰਜਾਬੀ 'ਚ ਗੱਲ ਕਰਨ ਠੀਕ ਹੈ ਜੀ ਕਿਉਂਕਿ ਆਪਣੀ ਮੇਨ ਭਾਸ਼ਾ ਪੰਜਾਬੀ ਹੈ ਠੀਕ ਹੈ ਜੀ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਾਂ ਨੂੰ ਪੰਜਾਬੀ ਸਿਖਾਉਣੀ ਚਾਹੀਦੀ ਹੈ